ਮੈਂ ਗੂਗਲ ਮੈਪ ਦੀ ਵਰਤੋਂ ਕਾਫੀ ਵਾਰੀ ਕੀਤੀ ਹੈ ਇਸ ਨਾਲ ਆਪਾਂ ਆਪਣਾ ਕਿਤੇ ਜਾਣ ਦੀ ਦਿਸ਼ਾ ਨਿਰਦੇਸ਼ ਪਾ ਸਕਦੇ ਹਾਂ ਉਸ ਤੋਂ ਇਲਾਵਾ ਜੇ ਜਿੱਥੇ ਆਪਾਂ ਜਾਣਾ ਉਸ ਦੀ ਉਸ ਜਗ੍ਹਾ ਦਾ ਨਾਂ ਲਿਖ ਕੇ ਕਿੰਨਾ ਸਮਾਂ ਉੱਥੇ ਲੱਗਣਾ ਅਤੇ ਕਿੰਨਾ ਰਸਤਾ ਹਜੇ ਰਿਹਾ ਉੱਥੇ ਤੱਕ ਪੁੱਜਣ ਲਈ ਅਤੇ ਜੇ ਰਸਤੇ ਵਿੱਚ ਕੋਈ ਰੁਕਾਵਟਾਂ ਹਾਂ ਤਾਂ ਉਹ ਵੀ ਆਪਾਂ ਜਾਣ ਸਕਦੇ ਹਾਂ ਹੈ ਉਸ ਟਾਈਮ ਲਾਈਵ ਦੱਸਦਾ ਹੈ ਕਿ ਜੇ ਰਸਤੇ ਵਿੱਚ ਕੋਈ ਬਲੋਕ ਹੈ ਕੋਈ ਕੁਛ ਹੜਤਾਲ ਚੱਲ ਰਹੀਆਂ ਕੁਛ ਹੋ ਰਿਹਾ ਉਹ ਸਭ ਇਹ ਦੱਸ ਕੇ ਸਾਨੂੰ ਦੱਸਦਾ ਹੈ ਕਿ ਕਿੰਨਾ ਸਮਾਂ ਤੁਹਾਨੂੰ ਹੋਰ ਲੱਗ ਜਾਣਾ ਅਤੇ ਕਿੰਨਾ ਰਸਤਾ ਹੋਰ ਹਜੇ ਪਿਆ ਹੈ ਇਸ ਤੋਂ ਇਲਾਵਾ ਇਹ ਸਾਨੂੰ ਸਭ ਤੋਂ ਛੋਟਾ ਰਸਤਾ ਵੀ ਦੱਸਦਾ ਹੈ ਕਿ ਹਾ ਸਾਡੇ ਪੁੱਜਣ ਵਾਲੀ ਜਗ੍ਹਾ ਤੱਕ ਸਭ ਤੋਂ ਛੋਟਾ ਰਸਤਾ ਸਾਨੂੰ ਕਿਹੜਾ ਪਏਗਾ ਜੇ ਵੇਖਿਆ ਜਾਏ ਤਾਂ ਇਸ ਜ਼ਿਆਦਾਤਰ ਸਾਨੂੰ ਉੱਥੇ ਕੰਮ ਆਉਂਦਾ ਜੇ ਆਪਾਂ ਕਿਤੇ ਘੁੰਮਣ ਗਏ ਹਾਂ ਜਿਹਦੀ ਜਗ੍ਹਾ ਜਾ ਬਾਰੇ ਆਪਾਂ ਨਹੀਂ ਜਾਣਦੇ ਉੱਥੇ ਇਹ ਚੀਜ਼ ਕਾਫੀ ਪਸੰਦ ਆਉਂਦੀ ਹੈ ਮੈਨੂੰ ਕਿਉਂਕਿ ਇਸ ਨਾਲ ਆਪਾਂ ਆਪਣੀ ਜਗ੍ਹਾ ਲੱਭ ਸਕਦੇ ਹਾਂ ਅਤੇ ਗੁੰਮ ਹੋਣ ਤੋਂ ਬਚ ਸਕਦੇ ਹਾਂ ਉਸ ਤੋਂ ਇਲਾਵਾ ਇਹ ਸਾਨੂੰ ਹੋਰ ਵੀ ਚੀਜ਼ਾਂ ਬਾਰੇ ਦੱਸਦਾ ਹੈ ਜਿਵੇਂ ਕਿਸੇ ਜਗ੍ਹਾ ਦੀ ਵਧੀਆ ਜੇ ਆਪਾਂ ਦੁਕਾਨ ਦੇਖਣੀ ਹੋਵੇ ਕਿ ਕਿਹੜੀ ਦੁਕਾਨ ਸਭ ਤੋਂ ਵਧੀਆ ਤਾਂ ਆਪਾਂ ਉਹਦੇ ਰਿਵਿਊ ਦੇਖਣੇ ਹੋਵੇ ਤਾਂ ਇਹ 'ਚ ਹੀ ਇਹ ਤੋਂ ਪਤਾ ਲੱਗ ਜਾਂਦੀ ਹੈ ਤਾਂ ਉਸ ਤੋਂ ਇਲਾਵਾ ਆਪਾਂ ਉੱਥੇ ਪੁੱਜ ਵੀ ਸਕਦੇ ਹਾਂ ਕਿਉਂਕਿ ਇਹ ਸਾਨੂੰ ਦਿਸ਼ਾ ਤਾਂ ਦੱਸਦਾ ਹੀ ਹੈ ਅਤੇ ਇਸ ਦੀ ਵਰਤੋਂ ਕਾਫੀ ਜਗ੍ਹਾ ਕੀਤੀ ਜਾਂਦੀ ਹੈ ਇਹ ਸਾਡੇ ਲਈ ਮਾਰਗ ਦਰਸ਼ਨ ਹੁੰਦਾ ਹੈ ਅਤੇ ਸਾਨੂੰ ਰਸਤਾ ਦੱਸੀ ਜਾਂਦਾ ਹੈ ਇਹ ਐਪ ਗੂਗਲ ਦੁਆਰਾ ਬਣਾਇਆ ਗਿਆ ਇਸ ਤੋਂ ਇਲਾਵਾ ਜੇ ਦੇਖਿਆ ਜਾਏ ਮੈਂ ਹੋਰ ਵੀ ਕਾਫੀ ਔਟੋਮੈਟਿਕ ਅਨੁਵਾਦਾਂ ਦੀ ਵਰਤੋਂ ਕੀਤੀ ਹੈ ਜਿਵੇਂ ਗੂਗਲ ਟ੍ਰਾਂਸਲੇਟਰ ਗੂਗਲ ਟ੍ਰਾਂਸਲੇਟਰ ਵੀ ਗੂਗਲ ਦੁਆਰਾ ਬਣਾਇਆ ਗਿਆ ਹੈ ਇਸ 'ਚੋਂ ਆਪਾਂ ਆਪਣੀ ਮਰਜ਼ੀ ਦੀ ਭਾਸ਼ਾ ਚੂਜ਼ ਕਰਕੇ ਉਹਨੂੰ ਟ੍ਰਾਂਸਲੇਟ ਕਰ ਸਕਦੇ ਹਾਂ ਜਿਵੇਂ ਜੇ ਮੈਂ ਚਾਹੁੰਦਾ ਹਾਂ ਇੰਗਲਿਸ਼ ਤੋਂ ਪੰਜਾਬੀ 'ਚ ਕਰਨ ਲਈ ਉਹ ਵੀ ਆਪਾਂ ਪਾਸ ਦਿੰਦੇ ਹਾਂ ਅਤੇ ਇੰਗਲਿਸ਼ ਵਿੱਚ ਆਪਣਾ ਇੰਗਲਿਸ਼ ਵਿੱਚ ਆਪਣਾ ਸਨਟੈਂਸ ਲਿਖ ਦਿੰਦੇ ਹਾਂ ਅਤੇ ਉਹ ਸਾਨੂੰ ਪੰਜਾਬੀ ਵਿੱਚ ਉਸਦਾ ਅਨੁਵਾਦ ਦੱਸ ਦਿੰਦਾ ਹੈ